ਮੈਂ ਰਵਿੰਦਰ ਸਿੰਘ ਸਵੇਰੇ ਚਾਰ ਵਜੇ ਉੱਠ ਕੇ ਸਾਡੇ ਪਿੰਡ ਦਾਣਾ ਮੰਡੀ ਦੇ ਵਿੱਚ ਹਰ ਰੋਜ਼ ਦੌੜਨ ਜਾਂਦਾ ਹਾਂ ਅਤੇ ਦੌੜਦੇ ਵਿੱਚ ਮੈਂ ਵੱਧ ਤੋਂ ਵੱਧ ਦੋ ਜਾਂ ਤਿੰਨ ਘੰਟੇ ਬਤੀਤ ਕਰਦਾ ਹੈ ਅਤੇ ਉਹਦੇ ਵੀ ਤਿੰਨ ਘੰਟਿਆਂ ਦੇ ਵਿੱਚ ਵਿੱਚ ਮੈਂ ਦੌੜਦਾ ਵੀ ਹਾਂ ਅਤੇ ਐਕਸਰਸੈਜ ਫਲੈਕਸੀਬਿਲਟੀ ਵੀ ਕਰਦਾ ਹਾਂ ਅਤੇ ਜਿਸ ਦੌਰਾਨ ਮੇਰਾ ਸਰੀਰ ਤੰਦਰੁਸਤ ਫੁਰਤੀਲਾ ਅਤੇ ਫਲੈਕਸੀਬਲ ਰਹਿੰਦਾ ਹੈ ਇਸ ਦੇ ਨਾਲ ਦੌੜਨ ਦੇ ਨਾਲ ਮੈਂ ਸਰੀਰ ਨੂੰ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਸਾਡੀ ਨਸਾਂ ਦੇ ਵਿੱਚ ਸ ਖੂਨ ਸਾਫ ਰਹਿੰਦਾ ਹੈ ਸਾਫ ਖੂਨ ਦੌੜਦਾ ਹੈ ਅਤੇ ਹਰ ਇੱਕ ਤਰ੍ਹਾਂ ਦੀ ਮਾਨਸਿਕ ਤਨਾਅ ਸਰੀਰਕ ਤਨਾਅ ਅਤੇ ਦਿਮਾਗੀ ਤਨਾਅ ਤੋਂ ਛੁਟਕਾਰਾ ਮਿਲਦਾ ਹੈ ਇਸ ਲਈ ਮੈਂ ਹਰ ਰੋਜ਼ ਸਵੇਰੇ ਚਾਰ ਵਜੇ ਉੱਠ ਕੇ ਦੌੜਨ ਸ ਜਾਂਦਾ ਹਾਂ ਦੌੜਦੇ ਸਮੇਂ ਮੈਂ ਮੈਂ ਵਾਹਿਗੁਰੂ ਵਾਹਿਗੁਰੂ ਦਾ ਮਨ ਦੇ ਵਿੱਚ ਜਾਪ ਕਰਦਾ ਹਾਂ ਅਤੇ ਨਾਲ ਹੀ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹਾਂ ਵੀ ਇੰਨੀ ਸੋਹਣੀ ਜ਼ਿੰਦਗੀ ਮੈਨੂੰ ਪਰਮਾਤਮਾ ਨੇ ਦਿੱਤੀ ਹੈ ਅਤੇ ਮੈਂ ਇਹਨੂੰ ਜਾਏ ਨਹੀਂ ਜਾਣ ਦੇਵਾਂਗਾ ਅਤੇ ਦੌੜ ਭੱਜ ਕੇ ਆਪ ਦੇ ਸਰੀਰ ਨੂੰ ਤੰਦਰੁਸਤ ਰੱਖਾਂਗਾ ਚਲਦੇ ਹੀ ਚਲਦੀ ਹੀ ਗੱਡੀ ਦੇ ਰਾਜੇ ਹੁੰਦੇ ਹਨ ਖੜ੍ਹੀ ਗੱਡੀ ਦੇ ਕੋਈ ਆ ਕੇ ਬੈਠਦਾ ਵੀ ਨਹੀਂ ਹੈ ਇਸ ਲਈ ਮੈਂ ਆਪਣੇ ਸਰੀਰ ਨੂੰ ਗਤੀਵਾਨ ਹੀ ਰੱਖਣਾ ਚਾਹੁੰਦਾ ਹਾਂ ਅਤੇ ਕਦੇ ਵੀ ਮੈਂ ਘਰ ਬੈਠ ਕੇ ਨਹੀਂ ਰਹਾਂਗਾ ਭੱਜ ਦੌੜ ਕਰਕੇ ਆਪ ਦੇ ਸਰੀਰ ਨੂੰ ਤੰਦਰੁਸਤੀ ਹਾਸਲ ਕਰਾਵਾਂਗਾ